ਸ਼੍ਰੀ ਸ਼ਾਮ ਲਾਲ ਜੀ ਸ਼੍ਰੀ ਮਦਨ ਲਾਲ ਜੀ ਸ਼੍ਰੀ ਹਰਬੰਸ ਲਾਲ ਜੀ ਸ੍ਰੀ ਗੁਰਦਾਸ ਰਾਮ ਜੀ ਅਤੇ ਸ਼੍ਰੀ ਦੇਸਰਾਜ ਜੀ